ਮੇਰੀ ਸਭ ਤੋਂ ਯਾਦਗਾਰੀ ਯਾਤਰਾ ਮਨੀ ਮਹੇਸ਼ ਦੀ ਯਾਤਰਾ ਹੈ ਇਹ ਯਾਤਰਾ ਮੈਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਅਤੇ ਮਨੀ ਮਹੇਸ਼ ਜਾ ਕੇ ਖਤਮ ਕੀਤੀ ਸੀ ਇਸ ਯਾਤਰਾ ਵਿੱਚ ਸਭ ਤੋਂ ਪਹਿਲਾਂ ਮੈਂ ਅੰਮ੍ਰਿਤਸਰ ਦੇ ਬਸ ਸਟੈਂਡ ਤੋਂ ਪਠਾਨਕੋਟ ਬੱਸ ਦੇ ਦੁਆਰਾ ਪਹੁੰਚਿਆ ਉਸ ਪਠਾਨਕੋਟ 'ਤੇ ਬਸ ਸਟੈਂਡ ਤੋਂ ਫਿਰ ਮੈਂ ਚੰਬਾ ਦੇ ਬਸ ਸਟੈਂਡ ਉੱਧਰ ਵੀ ਬਸ ਦੇ ਰਾਹੀਂ ਪਹੁੰਚਿਆ ਚੰਬਾ ਤੋਂ ਫਿਰ ਮੈਂ ਇੱਕ ਕਾਰ ਦੇ ਦੁਆਰਾ ਹਰਸਰਤ ਪਹੁੰਚਿਆ ਜੋ ਕਿ ਵ ਗੱਡੀਆਂ ਤੋਂ ਪਹੁੰਚਣ ਦਾ ਆਖਰੀ ਸਥਾਨ ਸੀ ਹਰਸਰਤ ਤੋਂ ਫਿਰ ਮੈਂ ਚੜ੍ਹਾਈ ਕੀ ਚਾਲੂ ਕੀਤੀ ਚੌਦ੍ਹਾਂ ਮੀਲ ਦੀ ਚੜ੍ਹਾਈ ਕਰਨ ਤੋਂ ਬਾਅਦ ਮੈਂ ਮਣੀ ਮਹੇਸ਼ ਪਹੁੰਚਿਆ ਅਤੇ ਉੱਥੇ ਜਾ ਕੇ ਮੇਰੀ ਯਾਤਰਾ ਸਮਾਪਤ ਹੁੰਦੀ ਸੀ ਇਸ ਯਾਤਰਾ ਦਾ ਮੈਨੂੰ ਸਭ ਤੋਂ ਯਾਦਗਾਰੀ ਪਲ ਇਹ ਲੱਗਾ ਇੱਥੇ ਮੈਂ ਕੁਦਰਤ ਦੇ ਬਹੁਤ ਹੀ ਖੂਬਸੂਰਤ ਨਜ਼ਾਰੇ ਵੇਖੇ ਉਸ ਤਰ੍ਹਾਂ ਦੇ ਨਜ਼ਾਰੇ ਆਮ ਬੰਦਾ ਕਦੇ ਹੀ ਵੇਖ ਸਕਦਾ ਹੋਏਗਾ ਮਨੀ ਮਹੇਸ਼ ਦਾ ਪੂਰਾ ਸਫਰ ਰਾਵੀ ਨਦੀ ਦੇ ਨਾਲ ਨਾਲ ਚੱਲਦਾ ਹੈ ਉਹ ਇੱਕ ਬਹੁਤ ਹੀ ਖੂਬਸੂਰਤ ਪਲ ਸਨ ਮਣੀ ਮਹੇਸ਼ ਹਿੰਦੂ ਧਰਮ ਦਾ ਇੱਕ ਵੱਡਾ ਆਸਥਾ ਦਾ ਕੇਂਦਰ ਵੀ ਹੈ